ਹਾਂਜੀ ਮੈਂ ਕੁਸ਼ਲਤਾ ਅਤੇ ਆਪਣੀ ਡਰਾਇੰਗ ਨੂੰ ਕੁਸ਼ਲਤਾ ਅਤੇ ਰਚਨਾਤਮਕਤਾ ਨੂੰ ਬਣਾਈ ਰੱਖਣ ਲਈ ਆਪਣੀ ਡਰਾਇੰਗ ਸਮੱਗਰੀ ਅਤੇ ਵਰਕ ਸਪੇਸ ਦਾ ਪ੍ਰਬੰਧ ਬੜੇ ਹੀ ਵਧੀਆ ਤਰੀਕੇ ਨਾਲ ਕਰਦੀ ਹਾਂ ਮੈਂ ਆਪਣੇ ਡਰਾਇੰਗ ਦਾ ਸਾਰਾ ਸਮਾਨ ਆਪਣੀ ਵਰਕ ਸਪੇਸ 'ਤੇ ਪ੍ਰੋਪਰ ਉਹਨੂੰ ਚੰਗੀ ਤਰ੍ਹਾਂ ਸਜਾ ਕੇ ਰੱਖਦੀ ਹਾਂ ਅਤੇ ਸਾਫ ਸੁਥਰਾ ਰੱਖਦੀ ਹਾਂ ਤਾਂ ਜੋ ਮੈਨੂੰ ਹਰੇਕ ਸਮਾਨ ਆਸਾਨੀ ਨਾਲ ਮਿਲ ਸਕੇ ਤਾਂ ਜੋ ਮੈਨੂੰ ਡਰਾਇੰਗ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਉਸ ਹਰੇਕ ਅਲੱਗ ਅਲੱਗ ਕਲਰ ਨੂੰ ਅਲੱਗ ਅਲੱਗ ਬਾਕਸ ਵਿੱਚ ਰੱਖਦੀ ਹਾਂ ਤਾਂ ਜੋ ਮਤਲਬ ਜਿਸ ਕਲਰ ਦੀ ਮੈਨੂੰ ਲੋੜ ਪਵੇ ਮੈਂ ਫਟਾਫਟ ਲੈ ਲਵਾਂ ਅਤੇ ਡਰਾਇੰਗ ਕਰ ਸਕਾਂ

ਧੰਨਵਾਦ